ਹੈਲੋ ਹਾਂਜੀ ਨਮਸਕਾਰ ਸਰ ਬੱਸ ਏਜੰਸੀ ਤੋਂ ਬੋਲਦੇ ਜੀ ਹਾਂ ਅਸੀਂ ਹਿਮਾਚਲ ਤੋਂ ਬੋਲਦੇ ਹੈ ਜੀ ਸਰ ਅਸੀਂ ਕ ਨਾ ਇੱਥੇ ਅਸੀਂ ਨਾ ਘੁੰਮਣ ਆਉਣਾ ਸੀ ਪੰਜਾਬ 'ਚ ਐਕਚੁਅਲੀ ਅਤੇ ਅਸੀਂ ਇਹ ਪੁੱਛਣਾ ਸੀ ਵੀ ਪੰਜਾਬ 'ਚ ਕਿਹੜੀ ਪਲੇਸਿਜ ਹੈ ਜਿਹੜੀ ਵੀ ਘੁੰਮਣ ਘੁੰਮਣ ਦੇ ਲਾਇਕ ਹੈ ਜਿਵੇਂ ਘੁੰਮਣ ਘੁੰਮਣਾ ਉਹਦਾ ਪੁੱਛਣਾ ਆਪਾਂ ਅੱਛਾ ਜੀ ਅੱਛਾ ਜੀ ਅੱਛਾ ਜੀ ਸਾਡੇ ਫੈਮਿਲੀ ਮੈਂਬਰ ਸਾਰੇ ਹੀ ਆ ਘੱਟੋਂ ਘੱਟ ਹੋਣੇ ਮੈਂ ਕਹਿੰਦਾ ਅੱਠ ਦਸ ਮੈਂਬਰ ਹੋਣੇ ਅਸੀਂ ਹਾਂਜੀ ਇਹ ਕਿੰਨੇ ਚਾਰਜਿਸ ਲੱਗਣਗੇ ਕਿੰਨੇ ਹੈ ਪੇ ਪੇਅਮੈਂਟ ਕਿੰਨੀ ਲੱਗ ਜੂਗੀ ਅੱਛਾ ਜੀ ਨਹੀਂ ਪੇਅਮੈਂਟ ਔਨਲਾਈਨ ਹੋ ਸਕਦੀ ਆ ਔਨਲਾਈਨ ਠੀਕ ਹੈ ਚਲੋ ਠੀਕ ਹੈ ਦੱਸਾਂਗੇ ਅਸੀਂ ਜੇ ਅਸੀਂ ਆਵਾਂਗੇ ਤੁਹਾਨੂੰ ਫ਼ੋਨ ਕਰਕੇ ਆਵਾਂਗੇ ਠੀਕ ਹੈ ਠੀਕ